ਭੰਗੜਾ ਇੱਕ ਪੰਜਾਬ ਦਾ ਇੱਕ ਲੋਕ ਨਾਚ ਹੈ ਅਸੀਂ ਭੰਗੜੇ ਨਾਲ ਬੜੇ ਫਿਟਨੈਸ ਵੀ ਰਹਿੰਦੇ ਹਾਂ ਬੜੇ ਫਿੱਟ ਰਹਿੰਦੇ ਭੰਗੜਾ ਪਾ ਕੇ ਅਤੇ ਸਾਨੂੰ ਅਸੀਂ ਭੰਗੜਾ ਐਰੋਬਿਕਸ ਨੂੰ ਰੂਟੀਨ ਵਿੱਚ ਭੰਗੜਾ ਅਸੀਂ ਤਾਂ ਸ਼ਾਮਿਲ ਕਰ ਸਕਦੇ ਭੰਗੜਾ ਇੱਕ ਪ੍ਰੋਪਰ ਬੀਟ 'ਤੇ ਹੁੰਦਾ ਵਾ ਢੋਲ ਦੀ ਬੀਟ 'ਤੇ ਭੰਗੜਾ ਹੀ ਕਰੀਦਾ ਹੁੰਦਾ ਵਾ ਜਦੋਂ ਅਸੀਂ ਪ੍ਰੋਪਰ ਬੀਟ ਨਾਲ ਕਰਾਂਗੇ ਤਾਂ ਅਸੀਂ ਭੰਗੜੇ ਦੇ ਇੱਕ ਇੱਕ ਸਟੈਪ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ ਇੱਕ ਬੀਟ ਨਾਲ ਇੱਕ ਅਤੇ ਭੰਗੜਾ ਕਰਨ ਨੂੰ ਸਾਨੂੰ ਪ੍ਰੋਪਰ ਫਿਟ ਹੋਣਾ ਚਾਹੀਦਾ ਵਾ ਪ੍ਰੋਪਰ ਸਾਨੂੰ ਆਕੜ ਹੋਣੀ ਚਾਹੀਦੀ ਥੋੜ੍ਹੀ ਜਿਹੀ ਅਤੇ ਪ੍ਰੋਪਰ ਸਾਨੂੰ ਜਦੋਂ ਭੰਗੜਾ ਕਰਦੇ ਹੋਣ ਤਾਂ ਸਾਨੂੰ ਪ੍ਰੋਪਰ ਲੱਗੇ ਕਿ ਆਹ ਪੂਰਾ ਇੱਕ ਜੱਟ ਕਰ ਰਿਹਾ ਵਾ ਪੂਰਾ ਭੰਗੜਾ ਅਤੇ ਉਹਦੇ ਨਾਲ ਬੜੇ ਵਧੀਆ ਲੱਗਦਾ ਸੀ ਭੰਗੜਾ ਬੜੇ ਵਧੀਆ ਹਰ ਮੌਕੇ 'ਤੇ ਕਰ ਸਕਦੇ ਹਾਂ ਅਸੀਂ ਭੰਗੜਾ ਜਦੋਂ ਅਸੀਂ ਜ਼ਿਆਦਾ ਖੁਸ਼ ਹੋਈਏ ਉਦੋਂ ਕਰ ਸਕਦੇ ਵਿਆਹ ਸ਼ਾਦੀਆਂ 'ਤੇ ਅਸੀਂ ਭੰਗੜਾ ਪਾਉਣ ਲੱਗ ਪੈਂਦੇ ਹਾਂ ਭੰਗੜਾ ਅਸੀਂ ਹਰ ਜਗ੍ਹਾ ਕਰ ਸਕਦੇ ਹਾਂ ਇਹ ਗਾਣਿਆਂ 'ਤੇ ਵੀ ਹੋ ਜਾਂਦਾ ਵਾ ਇਹ ਬੀਟਾਂ 'ਤੇ ਵੀ ਹੋ ਜਾਂਦਾ ਵਾ ਅਤੇ ਭੰਗੜਾ ਹੀ ਵਿਆਹ ਸ਼ਾਦੀਆਂ 'ਤੇ ਕਰ ਸਕਦੇ ਹਾਂ ਨੋਰਮਲ ਜਦੋਂ ਮਨ ਕੀਤਾ ਉਦੋਂ ਘਰ ਅਤੇ ਕਰ ਸਕਦੇ ਹਾਂ ਜਦੋਂ ਮਨ ਕੀਤਾ ਉਦੋਂ ਕਰ ਸਕਦੇ ਹਾਂ ਭੰਗੜਾ ਅਤੇ ਭੰਗੜਾ ਭੰਗੜਾ ਭੰਗੜਾ